ਪੰਜ ਮਈ ਉੱਨੀ ਸੌ ਨੜਿਨਵੇਂ ਦਸ ਜੂਨ ਉੱਨੀ ਸੌ ਅੱਸੀ ਅਠਾਰ੍ਹਾਂ ਅਗਸਤ ਦੋ ਹਜ਼ਾਰ ਚਾਰ ਚੌਦ੍ਹਾਂ ਜਨਵਰੀ ਦੋ ਹਜ਼ਾਰ ਸੱਤ ਗਿਆਰ੍ਹਾਂ ਫਰਵਰੀ ਦੋ ਹਜ਼ਾਰ ਵੀਹ